ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਵਿੱਚ ਰਹਿੰਦੇ ਆ ਰਹੇ ਸਾਰੇ ਵਿਅਕਤੀ ਪੰਜਾਬੀ ਭਾਸ਼ਾ ਬੋਲਦੇ ਹਨ ਜਿਵੇਂ ਕਿ ਆਪਾਂ ਪਹਿਲੀ ਤੋਂ ਲੈ ਕੇ ਸਾ ਸਾਰੀ ਜ਼ਿੰਦਗੀ ਪੰਜਾਬੀ ਭਾਸ਼ਾ ਨਾਲ ਗੱਲਬਾਤ ਕਰਦੇ ਹਾਂ ਕਿੱਦਾਂ ਬਾਹਰ ਜਾਈਦਾ ਉਥੇ ਵੀ ਗੱਲਬਾਤ ਕਰੀਦੀ ਆ ਆਪਣੇ ਗੀਤ ਪੰਜਾਬੀ 'ਚ ਹੁੰਦੇ ਆ ਸਿੱਧੂ ਮੂਸੇਵਾਲਾ ਹੋ ਗਿਆ ਜਾਂ ਕੋਈ ਹੋਰ ਕਰਨ ਔਜਲਾ ਹੋ ਗਿਆ ਆਪਣੇ ਪੰਜਾਬੀ ਲੋਕ ਬਹੁਤ ਹੀ ਪੰਜਾਬੀ ਭਾਸ਼ਾ ਵਿੱਚ ਗੱਲ ਕਰਨ ਵਾਲੇ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਆਪਣੇ ਜਿਹੜੇ ਲੋਕ ਆ ਉਹ ਵੀ ਪੰਜਾਬੀ 'ਚ ਬਾਹਰ ਕਾਰੋਬਾਰ ਕਰਦੇ ਨੇ ਬਾਹਰਲੇ ਲੋਕ ਆ ਗਏ ਇੰਡੀਆ 'ਚ ਪੰਜਾਬੀ ਸਿੱਖਦੇ ਨੇ ਕਿੱਦਾਂ ਹੁਣ ਮੈਂ ਆਪ ਪੰਜਾਬੀ ਹਾਂ ਅਤੇ ਮੈਨੂੰ ਪੰਜਾਬੀ ਬੋਲਣ ਵਿੱਚ ਬਹੁਤ ਮਾਣ ਹੁੰਦਾ ਹੈ ਪੰਜਾਬੀ ਖ਼ਾਸ ਕਰਕੇ ਪਿੰਡਾਂ ਵਿੱਚ ਬੋਲੀ ਜਾਂਦੀ ਆ ਜਿਹੜੇ ਬੈਕਵਰਡ ਪਿੰਡ ਹੁੰਦੇ ਆ ਪਿੰਡਾਂ 'ਚ ਸਭ ਤੋਂ ਪੁਰਾਣੀ ਪੰਜਾਬੀ ਬੋਲੀ ਜਾਂਦੀ ਆ ਆਪਣਾ ਪਾਕਿਸਤਾਨ 'ਚ ਵੀ ਪੰਜਾਬੀ ਬੋਲੀ ਜਾਂਦੀ ਆ ਉਰਦੂ ਹੋ ਗਈ ਪੰਜਾਬੀ ਨਾਲ ਸਾਰੀ ਗੱਲਬਾਤ ਹੁੰਦੀ ਆ ਕਿਹੜੇ ਔਲ ਵਰਡ ਵਿੱਚ ਹੁਣ ਤੁਹਾਨੂੰ ਪਤਾ ਕਿੱਦਾਂ ਅਮਰੀਕਾ ਹੋ ਗਿਆ ਇੰਗਲੈਂਡ ਹੋ ਗਿਆ ਉੱਥੇ ਪੰਜਾਬੀ ਭਾਸ਼ਾ ਇੱਕ ਲਾਜ਼ਮੀ ਭਾਸਾ ਭਾਸ਼ਾ ਸਕੂਲਾਂ 'ਚ ਵੀ ਪੰਜਾਬੀ ਭਾਸ਼ਾ ਬੋਲੀ ਜਾਂਦੀ ਆ ਪੜ੍ਹੀ ਜਾਂਦੀ ਆ ਪੰਜਾਬੀ ਵਿੱਚ ਬਹੁਤ ਸਾਰੀਆਂ ਗਲਤੀਆਂ ਵੀ ਹੁੰਦੀਆਂ ਪਰ ਪੰਜਾਬੀ ਜਿਹੜੀ ਭਾਸ਼ਾ ਬਹੁਤ ਹੀ ਲਾਭਦਾਇਕ ਹੁੰਦੀ ਆ ਪੰਜਾਬੀ ਭਾਸ਼ਾ ਨਾਲ ਆਪਾਂ ਕਿਹਦੇ ਨਾਲ ਮਰਜ਼ੀ ਗੱਲ ਕਰ ਸਕਦੇ ਹਾਂ ਅਤੇ ਜੋ ਪੰਜਾਬੀ ਭਾਸ਼ਾ ਵਾ ਉਹਦੇ ਨਾਲ ਆਪਾਂ ਆਪਣੇ ਪ੍ਰਭਾਵ ਪੈਂਦਾ ਦੂਜੇ ਉੱਤੇ